ਹੈਲੋ ਵਧੀਆ ਵਧੀਆ ਮੇਰੇ ਆਗੇ ਬਾਈ ਪਚਾਸੀ ਕੁ ਪ੍ਰਸੈਂਟ ਆ ਗਏ ਅੱਗੇ ਦੇਖਦੇ ਹਾਂ ਯਾਰ ਤੂੰ ਦੱਸ ਕੀ ਕਰਨਾ ਚੰਡੀਗੜ੍ਹ ਕੋਰਸ ਕਿਹੜਾ ਰੱਖਣਾ ਆਪਾਂ ਫਿਰ ਕੋਰਸ ਕੋਰਸ ਕੋਰਸ ਕਿਹੜਾ ਰੱਖਾਂਗੇ ਅੱਛਿਆ

ਪਲੇਸਮੈਂਟ ਉੱਥੇ ਵਗ਼ੈਰਾ ਕਿਵੇਂ ਪਲੇਸਮੈਂਟ ਵ ਪਲੇਸਮੈਂਟ ਕਿਵੇਂ ਨੇ ਉੱਥੇ ਠੀਕ ਹੈ ਠੀਕ ਹੈ ਅਤੇ ਅਪ ਡਾਊਨ ਦਾ ਔਖਾ ਹੋ ਜਾਇਆ ਕਰਨਾ ਯਾਰ ਚੰਡੀਗੜ੍ਹ ਕਿਥੇ ਆਉਣਾ ਜਾਣਾ ਹਾਂ

ਅੱਛਿਆ ਅੱਛਿਆ ਬਾਕੀ ਆਪਾਂ ਲਵੇ ਜਿਹੜੇ ਆ ਇੱਕ ਤਾਂ ਲਵੇ ਯੂਨੀਵਰਸਿਟੀਆਂ 'ਚ ਜਾ ਆਉਂਦੇ ਹਾਂ ਵੀ ਕੋਈ ਨਿਕਲ ਆਉਂਦੀ ਆ ਮਤਲਬ ਹਾਂ ਸਾਰੇ ਕਿਤੇ ਜਾਏ ਆਵਾਂਗੇ ਹਾਂ ਇਧਰ ਦੇਖ ਆਵਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਂ ਮਾਤਾ ਗੁਜਰੀ ਜੀ ਦੇ ਮਾਤਾ ਗੁਜਰੀ ਜੀ ਦੇਖੇ ਆਵਾਂਗੇ ਕੀ ਕਹਿੰਦੇ

ਚੱਲ ਦੇਖਾਂਗੇ ਫਿਰ ਦੇਖਦੇ ਹਾਂ ਜਾ ਕੇ ਆਉਣੇ ਹਾਂ ਫਿਰ ਜਾ ਆਵਾਂਗੇ ਸੋਮਵਾਰ ਨੂੰ ਜਾ ਆਉਂਦੇ ਕੱਲ੍ਹ ਨੂੰ ਜਾਏ ਆਵਾਂਗੇ ਚੱਲ ਹਾਂ ਠੀਕ ਹੈ ਹਾਂ ਕੋਈ ਨਹੀਂ ਤਿਆਰ ਰਹਾਂਗੇ ਮਾਤਾ ਮਾਤਾ ਗੁਜਰੀ ਜਾਏ ਆਵਾਂਗੇ ਪਹਿਲਾਂ ਫ਼ਿਰ ਚਲਾਂਗੇ ਸੀ ਯੂ 'ਚ ਚੱਲ ਠੀਕ ਠੀਕ ਠੀਕ